ਸਾਡਾ ਬਹੁਤ ਸੋਹਣਾ ਭਰਪੂਰ ਅਤੇ ਵੱਡਾ ਪਰਿਵਾਰ ਹੈ ਅਸੀਂ ਸਾਰੇ ਜੁਆਇੰਟ ਫੈਮਲੀ ਇਕੱਠੇ ਹੀ ਰਹਿੰਦੇ ਹਾਂ ਸਾਰਿਆਂ ਵਿੱਚ ਸਾਨੂੰ ਸਾਡਾ ਬਹੁਤ ਪ੍ਰੇਮ ਪਿਆਰ ਹੈ ਅਸੀਂ ਇੱਕੋ ਰਸੋਈ ਵਿੱਚ ਖਾਣਾ ਇਕੱਠੇ ਪਕਾਉਂਦੇ ਹਾਂ ਮਿਲ ਰਲ ਮਿਲ ਕੇ ਰਹਿੰਦੇ ਹਾਂ ਬੱਚਿਆਂ ਦਾ ਵੀ ਆਪਸ ਵਿੱਚ ਬਹੁਤ ਪ੍ਰੇਮ ਹੈ ਵੱਡੇ ਵੀ ਆਪਣੇ ਪੂਰੇ ਪ੍ਰੇਮ ਪਿਆਰ ਨਾਲ ਇੱਕ ਦੂਸਰੇ ਦਾ ਦੁੱਖ ਸੁੱਖ ਸਾਂਝਾ ਕਰਦੇ ਹਾਂ ਅਤੇ ਰੋਟੀ ਅਸੀਂ ਇਕੱਠੇ ਬੈਠ ਕੇ ਖਾਂਦੇ ਹਾਂ ਸਾਡਾ ਆਪਸ ਵਿੱਚ ਬਹੁਤ ਪ੍ਰੇਮ ਪਿਆਰ ਭਰਪੂਰ ਤਰ੍ਹਾਂ ਭਰਪੂਰ ਭਰ ਕੇ ਬਣਿਆ ਹੋਇਆ ਹੈ ਅਸੀਂ ਇਕੱਠੇ ਘੁੰਮਣ ਫਿਰਨ ਜਾਂਦੇ ਹਾਂ ਅਤੇ ਹੋਰ ਸਾਡੇ ਫਰੈਂਡ ਦੋਸਤਾਂ ਨਾਲ ਅੱਛੀ ਤਰ੍ਹਾਂ ਬਣੀ ਹੋਈ ਹੈ ਉਹ ਵੀ ਸਾਡੇ ਨਾਲ ਘੁੰਮਣ ਫਿਰਨ ਜਾਂਦੇ ਨੇ ਸਾਡੇ ਦੁੱਖ ਸੁੱਖ 'ਤੇ ਕੰਮ ਆਉਂਦੇ ਨੇ ਸਾਡੇ ਨਾਲ ਸਾਰੇ ਦੋਸਤ ਭੈਣ ਭਰਾਵਾਂ ਵਰਗਾ ਹੀ ਰਹਿੰਦੇ ਨੇ ਅਸੀਂ ਇੱਕੋ ਥਾਲੀ ਵਿੱਚ ਬੈਠ ਕੇ ਖਾ ਪੀ ਲੈਂਦੇ ਹਾਂ ਸਾਰੇ ਦੋਸਤ ਬਹੁਤ ਚੰਗੇ ਨੇ ਪਰਮਾਤਮਾ ਨੂੰ ਮੰਨਣ ਵਾਲੇ ਨੇ ਅਤੇ ਚੰਗੀਆਂ ਨੇਕੀ ਦੀਆਂ ਗੱਲਾਂ ਕਰਦੇ ਨੇ